ਪੰਜਾਬ ਦੇ ਜਿਹੜੇ ਲੋਕ ਹੁੰਦੇ ਆ ਉਹ ਬੜੇ ਹੀ ਜ਼ਿਆਦਾ ਮਤਲਬ ਖੁੱਲ੍ਹੇ ਦਿਲ ਹੁੰਦੇ ਆ ਮਤਲਬ ਜਦੋਂ ਵੀ ਕੋਈ ਖੇਤਰ ਨੂੰ ਸਾਡੀ ਸਹਾਇਤਾ ਹੁੰਦੀ ਆ ਜਿਵੇਂ ਕਿ ਅ ਕੇਰਲਾ ਨੂੰ ਜਾਂ ਕਿਸੇ ਨੂੰ ਵੀ ਸਾਡੀ ਸਹਾਇਤਾ ਹੁੰਦੀ ਹੈ ਤਾਂ ਉਹ ਮਤਲਬ ਉਹਨਾਂ ਨੂੰ ਫੂਡ ਪ੍ਰੋਵਾਈਡ ਕਰਦੀ ਆ ਪ੍ਰੀਵੈਂਟ ਕਰਦੀ ਆ ਮਤਲਬ ਫਾਇਰ ਤੋਂ ਪ੍ਰੀਵੈਂਟ ਕਰਦੇ ਆ ਫਲੱਡ ਤੋਂ ਪ੍ਰੀਵੈਂਟ ਕਰਦੇ ਉਹਨਾਂ ਨੂੰ ਉਹਨਾਂ ਦੇ ਘਰ ਬਣਾ ਕੇ ਦਿੰਦੇ ਆ ਉਹਨਾਂ ਨੂੰ ਮਤਲਬ ਅੱਜ ਕੱਲ੍ਹ ਬਹੁਤ ਜ਼ਿਆਦਾ ਸੁਸਾਈਟੀਜ਼ ਓਪਨ ਹੋ ਗਈਆਂ ਜਿਹਦੇ ਵਿੱਚ ਮਤਲਬ ਜਿਹੜੇ ਪੰਜਾਬ ਦੇ ਇਨਸਾਨ ਹੈਗੇ ਖਾਲਸਾ ਏਡ ਵਾਲੇ ਆ ਉਹ ਬਾਹਰ ਦੇ ਲੋਕਾਂ ਨੂੰ ਜਿੱਦਾਂ ਕੋਈ ਵੀ ਗਰੀਬ ਇਨਸਾਨ ਹੁੰਦੇ ਉਹਨਾਂ ਦੀ ਹੈਲਪ ਕਰਦੇ ਆ ਜੰਗਲਾਂ ਵਿੱਚ ਜਿਹੜੇ ਇਨਸਾਨ ਖੋਏ ਹੁੰਦੇ ਆ ਉਹ ਗੁਆਚ ਜਾਂਦੇ ਉਹਨਾਂ ਨੂੰ ਮਤਲਬ ਲੱਭਦੇ ਆ ਅਤੇ ਜਿਹੜੇ ਪੰਜਾਬ ਦੇ ਮਤਲਬ ਜਿਹੜੇ ਪੰਜਾਬੀ ਇਨਸਾਨ ਹੈਗੇ ਆ ਉਹ ਕਾਫ਼ੀ ਜ਼ਿਆਦਾ ਸੋਫਟ ਹਾਰਟਿਡ ਪਰਸਨ ਹੁੰਦੇ ਆ